ਹੈਲੋ ਤੁਸੀਂ ਕੈਬ ਦਫਤਰ ਤੋਂ ਬੋਲਦੇ ਹੋ ਅਸੀਂ ਤੁਹਾਡੀ ਕੱਲ ਇੱਕ ਕੈਬ ਬੁੱਕ ਕੀਤਾ ਸੀ ਜੋ ਕੀ ਟਾਈਮ ਸਿਰ ਨਹੀਂ ਪਹੁੰਚ ਸਕਿਆ ਅਸੀਂ ਮਾਨਸਾ ਤੋਂ ਲੁਧਿਆਣਾ ਜਾਣਾ ਸੀ ਕੱਲ ਚਾਰ ਵਜੇ ਦਾ ਅਸੀਂ ਟਾਈਮ ਦਿੱਤਾ ਸੀ ਤੇ ਸਾਡੇ ਕੋਲ ਚਾਰ ਵਜੇ ਤੀਕਰ ਕੋਈ ਤੁਹਾਡਾ ਡਰਾਈਵਰ ਨਹੀਂ ਪਹੁੰਚ ਸਕਿਆ ਫਿਰ ਅਸੀਂ ਫੋਨ ਕੀਤਾ ਤਾਂ ਉਸਨੇ ਸਾਨੂੰ ਦੂਸਰਾ ਨੰਬਰ ਦਿੱਤਾ ਦੂਸਰਾ ਨੰਬਰ ਦੇਣ ਦੇ ਬਾਵਜੂਦ ਵੀ ਸਾਡੇ ਕੋਲ ਕੈਬ ਨਹੀਂ ਪਹੁੰਚਿਆ ਡਰਾਈਵਰ ਵੀ ਲੇਟ ਚੱਕਿਆ ਸੀ ਕੀ ਉਹ ਸਾਡੇ ਕੋਲ ਪੰਜ ਸਵਾ ਪੰਜ ਵਜੇ ਤੀਕਰ ਵੀ ਨਹੀਂ ਪਹੁੰਚਾ ਅਸੀਂ ਅਗਾਂਹ ਪੇਪਰ ਦੇਣ ਜਾਣਾ ਸੀ ਜੋ ਕਿ ਅਸੀਂ ਨਹੀਂ ਸਾਡਾ ਪੇਪਰ ਵੀ ਨਹੀਂ ਹੋ ਸਕਿਆ ਇਸ ਕਰਕੇ ਅਸੀਂ ਜੋ ਕੱਲ ਤੁਹਾਡੇ ਕੋਲ ਕੈਬ ਬੁੱਕ ਕੀਤੀ ਹੈ ਉਹ ਅਸੀਂ ਹੁਣ ਰੱਦ ਕਰਨੀ ਚਾਹੁੰਦੇ ਹਾਂ ਤੁਹਾਡੇ ਡਰਾਈਵਰ ਕਰਕੇ ਅਸੀਂ ਲੇਟ ਹੋ ਗਏ ਤੁਹਾਡੇ ਕੈਬ ਸਾਡੇ ਕੋਲ ਸਮੇਂ ਸਿਰ ਨਹੀਂ ਪਹੁੰਚ ਸਕਿਆ ਜੋ ਕਿ ਸਾਨੂੰ ਡਰਾਈਵਰ ਨੇ ਵੀ ਦੂਸਰਾ ਨੰਬਰ ਦਿੱਤਾ ਉਹਨੇ ਵੀ ਸਾਡੇ ਕੋਲ ਟਾਈਮ ਸਿਰ ਪਹੁੰਚਣ ਦੀ ਕਿਰਪਾਲਤਾ ਨਹੀਂ ਕੀਤੀ ਜਿਸ ਕਰਕੇ ਅਸੀਂ ਪੇਪਰ ਵੀ ਨਹੀਂ ਦੇ ਸਕੇ ਅਸੀਂ ਤੁਹਾਡੇ ਡਰਾਈਵਰ ਦੀ ਲਾਪਰਵਾਹੀ ਕਰਕੇ ਅਸੀਂ ਲੇਟ ਹੋ ਗਏ ਜਿਸ ਕਰਕੇ ਅਸੀਂ ਕੱਲ ਜੋ ਕੈਬ ਕੀਤੀ ਸੀ ਉਹ ਅਸੀਂ ਹੁਣ ਕੈਂਸਲ ਕਰਨੀ ਚਾਹੁੰਦੇ ਹਾਂ ਸਾਨੂੰ ਉਸਦਾ ਦੱਸੋ ਸਲਿਊਸ਼ਨ ਕੀ ਹੈ ਜੋ ਕੀ